ਰਾ ਫੋਨ ਨੋਕੀਆ ਤਾਂ ਸੀ ਉਹ ਇੱਕ ਬਟਨਾ ਵਾਲਾ ਫੋਨ ਸੀ ਉਹ ਇੱਕ ਸਮਾਟਫੋਨ ਨਹੀਂ ਸੀ ਉਸ ਦੇ ਵਿੱਚ ਫੋਟੋ ਖਿੱਚਣ ਦਾ ਸਿਲਸਿਲਾ ਨਹੀਂ ਸੀ ਉਸ ਵਿੱਚ ਕੇਵਲ ਫੋਨ ਹੀ ਕੀਤਾ ਜਾਂਦਾ ਸੀ ਪਰ ਹੁਣ ਅੱਜ ਸਮਾਰਟਫੋਨ ਆ ਗਿਆ ਹੈ ਇਸ ਵਿੱਚ ਵਧੀਆ ਵਧੀਆ ਫੀਚਰ ਹੁੰਦੇ ਹਨ ਅੱਜ ਕੱਲ੍ਹ ਬੱਚੇ ਬੱਚੇ ਦੇ ਹੱਥ ਸਮਾਟਫੋਨ ਹੁੰਦਾ ਹੈ ਕੋਈ ਵੀ ਨੋਕੀਆਂ ਦਾ ਫੋਨ ਲੈਣਾ ਪਸੰਦ ਨਹੀਂ ਕਰਦਾ ਸਾਡੀ ਜ਼ਿੰਦਗੀ ਵਿੱਚ ਜਿੰਨਾ ਸਮਾਰਟਫੋਨ ਦਾ ਚੰਗਾ ਅਸਰ ਹੁੰਦਾ ਹੈ ਓਨਾ ਗਲਤ ਵੀ ਹੋ ਸਕਦਾ ਹੈ ਸਮਾਰਟਫੋਨ ਦੇ ਰਾਹੀਂ ਅਸੀਂ ਗੂਗਲ ਪੇ ਦੀ ਵਰਤੋਂ ਵੀ ਕਰ ਕੀਤੀ ਜਾ ਸਕਦੀ ਹੈ ਜੋ ਬਿਨਾਂ ਸਮਾਰਟਫੋਨ ਤੋਂ ਨਹੀਂ ਕੀ ਜਾ ਸਕਦੇ ਸਮਾਰਟਫੋਨ ਵਿੱਚ ਇੱਕ ਦੂਜੇ ਦੀਆਂ ਸ਼ਕਲਾਂ ਵੇਖ ਸਕਦੇ ਹਾਂ ਸਮਾਰਟਫੋਨ ਦਾ ਅਹਿਮ ਪ੍ਰਭਾਵ ਹੈ ਕਿ ਅਸੀਂ ਉੱਥੇ ਜੇ ਕਿੱਥੇ ਜਾਣਾ ਵੀ ਹੋਵੇ ਉੱਥੋਂ ਦਾ ਪਤਾ ਵੀ ਲਗਾ ਸਕਦੇ ਹਾਂ ਸਮਾਰਟਫੋਨ ਦੀ ਇੱਕ ਹਾਨੀ ਇਹ ਹੈ ਕਿ ਬੱਚੇ ਗਲਤ ਕੰਮਾਂ ਦਾ ਪ੍ਰਯੋਗ ਕਰਦੇ ਹਨ ਅਤੇ ਭੈੜੀ ਸੰਗਤ ਵਿੱਚ ਪੈ ਜਾਂਦੇ ਹਨ ਸਮਾਰਟਫੋਨ ਵਿੱਚ ਟਵੀਟਰ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਇੰਟਰਨੈਟ ਗੂਗਲ ਵਰਗੀਆਂ ਐਪਾਂ ਵੀ ਹਨ ਪਹਿਲਾਂ ਤਾਂ ਫੌਰ ਜੀ ਫੋਨ ਵੀ ਨਹੀਂ ਹੁੰਦਾ ਸੀ ਅੱਜ ਕੱਲ੍ਹ ਫਾਈਵ ਜੀ ਫੌਨ ਆ ਗਿਆ ਹੈ ਸਾਇੰਸ ਅਤੇ ਟੈਕਲੋਲਜੀ ਨੇ ਬਹੁਤ ਵੱਡੇ ਖੇਤਰ ਵਿੱਚ ਆਪਣਾ ਸਥਾਨ ਬਣਾ ਲਿਆ ਹੈ ਅੱਜ ਕੱਲ੍ਹ ਮੋਬਾਈਲ ਫੋਨਾਂ ਉੱਤੇ ਅਜਿਹੀ ਐਪ ਵੀ ਮੌਜੂਦ ਹੈ ਜਿਹੜਾ ਤੁਹਾਡੀ ਸਿਹਤ 'ਤੇ ਨਜ਼ਰ ਰੱਖਦਾ ਹੈ ਉਹ ਤੁਹਾਡੇ ਸੌਣ ਜਾਗਣ ਅਤੇ ਸੈਰ ਲਈ ਪੁੱਟੇ ਕਦਮਾਂ ਦੇ ਬਿਤਾਏ ਵਕਤ ਤੋਂ ਇਲਾਵਾ ਤੁਹਾਡੇ ਦਿਲ ਦੀ ਧੜਕਣ ਅਤੇ ਬੇਚੈਨੀ ਬਾਰੇ ਵੀ ਜਾਣਕਾਰੀ ਦਿੰਦਾ ਹੈ ਇਸ ਦਾ ਲਾਭ ਉਠਾ ਕੇ ਮਨੁੱਖ ਆਪਣੀ ਸਿਹਤ ਸਬੰਧੀ ਚੇਤਨ ਰਾਹੀਂ ਸਕਤਾ ਹੈ ਮੋਬਾਇਲ ਫੋਨ ਉੱਤੇ ਪ੍ਰਾਪਤ ਐਮ ਐਸ ਐਸ ਐਮ ਐਸ ਐਸ ਦੇ ਨਾਲ ਹੀ ਐਮ ਐਮ ਐਸ ਦੀ ਸਹੂਲਤ ਜਿੱਥੇ ਲੋਕਾਂ ਨੂੰ ਇੱਕ ਦੂਜੇ ਨਾਲ ਕਈ ਪ੍ਰਕਾਰ ਦਾ ਸੰਚਾਰ ਕਰਨ ਅਤੇ ਆਪਸ ਵਿੱਚ ਲਤੀਫੇ ਅਤੇ ਦਿਲ ਲਗੀਆਂ ਦੇ ਆਦਾਨ ਪ੍ਰਦਾਨ ਕਰ ਕੇ ਮਨ ਨੂੰ ਟਿਕਾਓ ਮੁਕਤ ਕਰਨ ਦਾ ਪਦਾਰਥ ਮੋਹਨੀਆ ਕਰਦੀਆਂ ਹਨ ਉੱਥੇ ਨਾਲ ਹੀ ਉਹਨਾਂ ਦੀ ਟੈਲੀਵਿਜ਼ਨ ਵਿੱਚ ਦਿਖਾਏ ਜਾ ਰਹੇ ਕਈ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਸ਼ਖੂਲੀਅਤ ਕਰ ਕੇ ਉਸ ਅੰਦਰ ਮੁਕਾਬਲੇਬਾਜ਼ੀ ਦੀ ਭਾਵਨਾ ਆਸ਼ਾਵਾਦ ਅਤੇ ਜਗਿਆਸਾ ਨੂੰ ਵੀ ਵਧਾਉਂਦੀਆਂ ਇਸ ਤਰ੍ਹਾਂ ਮੋਬਾਇਲ ਫੋਨ ਦਾ ਜ਼ਿੰਦਗੀ ਵਿੱਚ ਬਹੁਤ ਵੱਡਾ ਅਸਰ ਹੈ